ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਵਸਨੀਕ ਹਾਂ ਮੈਂ ਤੁਹਾਨੂੰ ਕੁਛ ਮਸ਼ਹੂਰ ਡਾਂਸਿੰਗ ਯੂਟੀਊਬ ਚੈਨਲਾਂ ਬਾਰੇ ਦੱਸਣਾ ਚਾਹੁੰਦੀ ਜੋ ਕਿ ਹੋਂਦ ਵਿੱਚ ਆਏ ਹਨ ਜਿਵੇਂ ਕਿ ਸੋਨੀ ਉੱਪਰ ਡਾਂਸ ਇੰਡੀਆ ਡਾਂਸ ਇਹ ਯੂਟੀਊਬ ਦੇ ਮਸ਼ਹੂਰ ਚੈਨਲ ਸਨ ਇਸ ਵਿੱਚ ਡਾਂਸ ਇੰਡੀਆ ਡਾਂਸ ਵਿੱਚ ਬੱਚਿਆਂ ਦੇ ਅਲੱਗ ਅਲੱਗ ਪਰਫੋਰਮੈਂਸ ਦਿਖਾਏ ਜਾਂਦੇ ਹਨ ਜਿਸ ਵਿੱਚ ਬੱਚੇ ਡਾਂਸ ਕਰਕੇ ਦਿਖਾਉਂਦੇ ਹਨ ਅਤੇ ਉਹਨਾਂ ਦੀ ਵਧੀਆ ਸਟੇਸਟ ਕੱਢੀ ਜਾਂਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਡਾਂਸ ਕਰਦੇ ਹਨ ਉਹਨਾਂ ਦੀਆਂ ਆਫਸਨਸ ਕੱਢੀਆਂ ਜਾਂਦੀਆਂ ਹਨ ਅਤੇ ਕੁਝ ਸਾਡੇ ਕੋਲ ਟੀ ਵੀ ਸ਼ੋ ਵੀ ਆ ਜਾਂਦੇ ਹਨ ਜਿਸ ਵਿੱਚ ਜਿਸ ਵਿੱਚ ਜਿਸ ਜਿਸ ਵਿੱਚ ਟੀ ਵੀ ਸ਼ੋ ਵੀ ਆ ਜਾਂਦੇ ਹਨ ਜਿਸ ਵਿੱਚ ਡੀ ਡੀ ਪੰਜਾਬੀ ਸੋਨੀ ਵਾ ਅਤੇ ਮਨੋਰੰਜਨ ਟੀ ਵੀ ਵੀ ਆ ਜਾਂਦਾ ਹੈ ਕਿ ਉਹ ਵੀਡੀਓਜ਼ ਵਿੱਚ ਲੋਕ ਨਾਚ ਵੀ ਦਿਖਾਏ ਜਾਂਦੇ ਹਨ ਇਹਨਾਂ ਨਾਟਕਾਂ ਵਿੱਚ ਵੀਡੀਓਜ਼ ਸ਼ੋ ਵੀ ਦਿਖਾਏ ਜਾਂਦੇ ਹਨ ਲੋਕ ਨਾਚ ਵੀ ਦਿਖਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਸਾਡੇ ਪੁਰਾਣੇ ਸੱਭਿਆਚਾਰ ਬਾਰੇ ਪਤਾ ਲੱਗੇ ਲੋਕ ਲੋਕ ਨਾਚ ਬਾਰੇ ਪਤਾ ਲੱਗੇ ਉਹ ਨਾਟਕ ਦੁਆਰਾ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਸਿੱਖ ਸਕਣ ਉਸ ਦਾ ਮਨੋਰੰਜਨ ਮਾਣ ਸਕਣ ਡੀ ਯੂਟੀਊਬ ਵੀ ਸਾਡੀ ਇਸ ਵਿੱਚ ਬਹੁਤ ਮਦਦਗਾਰ ਹੁਣ ਲ ਲੋਕ ਨਾਚ ਵਿੱਚ ਵੱਖਰਾ ਪਰਿਵਰਤਨ ਆ ਗਿਆ ਜਿੱਦਾਂ ਯੂਟੀਊਬ ਵਿੱਚ ਦਿਖਾਇਆ ਜਾਂਦਾ ਹੈ ਜਿਵੇਂ ਬੱਚੇ ਡਾਂਸ ਕਰਦੇ ਹਨ ਨਵੇਂ ਨਵੇਂ ਗੀਤਾਂ 'ਤੇ ਨਵੇਂ ਨਵੇਂ ਤਰੀਕੇ ਨਾਲ ਲੋਕ ਨਾਚ ਕਰਦੇ ਸਨ ਅਤੇ ਪਹਿਲਾਂ ਦੇ ਸਮਿਆਂ ਵਿੱਚ ਭੰਗੜਾ ਪਾਉਂਦੇ ਸਨ ਕੁੜਤਾ ਪਜਾਮਾ ਪਾ ਕੇ ਚਾਦਰਾ ਬੰਨ੍ਹ ਕੇ ਭੰ ਭੰਗੜਾ ਪਾਉਂਦੇ ਹਨ ਓਦਾਂ ਦੇ ਆਪਣੇ ਉਹੀ ਸੱਭਿਆਚਾਰ ਨੂੰ ਵਾਪਸ ਲਿਆਉਣ ਲਈ ਇਹ ਸਾਰੇ ਪ੍ਰੋਗਰਾਮ ਟੀ ਵੀ ਸ਼ੋ ਜਿੱਦਾ ਟਿਊ ਯੂਟਿਊਬ ਚੈਨਲ ਚਲਾਏ ਜਾਂਦੇ ਹਨ ਤਾਂ ਕਿ ਲੋਕ ਲੋਕ ਨਾਚ ਬਾਰੇ ਜਾਗਰੂਕ ਹੋ ਚ ਸਕਣ ਤਾਂ ਕਿ ਉਹਨਾ ਨੂੰ ਇਹ ਪਤਾ ਚੱਲੇ ਕਿ ਆਪਣਾ ਪ ਪੁਰਾਣਾ ਸਭਿਆਚਾਰ ਇਹ ਸੀ ਅਤੇ ਇਸ ਤਰ੍ਹਾਂ ਬਾਰੇ ਗੱਲਬਾਤ ਕੀਤੀ ਜਾਵੇ